ਹਾਂ ਮੈਂ ਇਹ ਸੋਚਦੀ ਹਾਂ ਮੇਰੀ ਜਿਹੜੀ ਫੋਟੋਗ੍ਰਾਫੀ ਹੈ ਉਹ ਦੂਜਿਆਂ ਤੋਂ ਵੱਖਰਾ ਇਸ ਕਰਕੇ ਬਣਾਉਂਦੀ ਹੈ ਕਿਉਂਕਿ ਮੈਂ ਇਹਦੇ ਵਿੱਚ ਨੈਚਰਲ ਫੋਟੋਗ੍ਰਾਫੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਹਾਂ ਮਹੱਤਵਪੂਰਨ ਤਰੀਕਾ ਇਹਦਾ ਇਹ ਹੀ ਹੈ ਬਹੁਤ ਹੀ ਉਪਚਾਰਿਕ ਤਰੀਕਾ ਵੀ ਇਹ ਹੀ ਹੈ ਕਿ ਤੁਸੀਂ ਆਪਣੀ ਫੋਟੋ ਕਿੱਦਾਂ ਨੈਚੁਰਲ ਤਰੀਕੇ ਨਾਲ ਖਿੱਚ ਸਕਦੇ ਹੋ ਇਹ ਤੁਹਾਡੀ ਤਕਨੀਕ ਹੋਰਾਂ ਤੋਂ ਵੱਖਰਾ ਹੀ ਬਣਾਉਂਦੀ ਹੈ ਕੋਈ ਇਨਸਾਨ ਦੀ ਤੁਸੀਂ ਫੋਟੋ ਲੈਣੀ ਹੈ ਕਿਸੇ ਫੁੱਲਾਂ ਦੀ ਅਸੀਂ ਫੋਟੋ ਲੈਣੀ ਹੈ ਕਿਸੇ ਪ੍ਰਾਕਿਰਤਿਕ ਨਜ਼ਾਰੇ ਦੀ ਅਸੀਂ ਫੋਟੋ ਲੈਣੀ ਹੈ ਇਹ ਸਾਨੂੰ ਉਦੋਂ ਹੀ ਵੱਖਰਾ ਬਣਾਉਂਦੀ ਹੈ ਕਿਸੇ ਵੀ ਇਨਸਾਨ ਤੋਂ ਜਦੋਂ ਅਸੀਂ ਇਹਦੀ ਅਲੱਗ ਤਰੀਕੇ ਦੇ ਨਾਲ ਫੋਟੋਗ੍ਰਾਫੀ ਕਰਦੇ ਹਾਂ ਜਿੱਦਾਂ ਅਸੀਂ ਨੇੜੇ ਤੋਂ ਕਿਸ ਤਰ੍ਹਾਂ ਖਿੱਚਣੀ ਹੈ ਅਸੀਂ ਦੂਰ ਜਾ ਕੇ ਕਿੱਦਾਂ ਫੋਟੋਗ੍ਰਾਫੀ ਖਿੱਚਣੀ ਹੈ ਇਹ ਤਰੀਕੇ ਦੇ ਕਰਕੇ ਹੀ ਅਸੀਂ ਹੋਰਾਂ ਤੋਂ ਵੱਖਰਾ ਅਨੁਭਵ ਕਰਦੇ ਹਾਂ ਸਾਡੀ ਇਹ ਤਕਨੀਕ ਹੋਰਾਂ ਤੋਂ ਅਲੱਗ ਦਰਸ਼ਾਉਂਦੀ ਹੈ ਕਿ ਅਸੀਂ ਫੋਟੋਗਰਾਫੀ ਨੂੰ ਦੂਜਿਆਂ ਤੋਂ ਇਸ ਕਰਕੇ ਵੀ ਵੱਖਰਾ ਦੱਸਦੇ ਹਾਂ ਕਿ ਸਾਡੇ ਜਿਹੜੇ ਫੋਟੋਗ੍ਰਾਫੀ ਹੈ ਉਹ ਸਹੀ ਮਾਇਨੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਆਵੇ ਉਹ ਕਿਸ ਤਰ੍ਹਾਂ ਆ ਸਕਦੀ ਹੈ ਉਹ ਇਸ ਤਰ੍ਹਾਂ ਆ ਸਕਦੀ ਹੈ ਕਿ ਅਸੀਂ ਨੈਚੁਰਲ ਤਰੀਕੇ ਨਾਲ ਜੇ ਖਿੱਚਿਆ ਜਾ ਸਕਦੀ ਹੈ ਕੋਈ ਵੀ ਫੋਟੋ ਕਲੋਜਅਪ ਦੂਰ ਨੇੜੇ ਉਹ ਸਹੀ ਢੰਗ ਨਾਲ ਕੀਤੀਆ ਜਾਂਦੀਆ ਹਨ